ਮੈਂ ਕਲਮਕਾਰੀ ਪੇਂਟਿੰਗ ਵਿੱਚ ਇੰਟਰਸਟ ਰੱਖਦੀ ਹਾਂ ਕਿਉਂਕਿ ਮੈਨੂੰ ਕਲਮ ਨਾਲ ਡਰੋ ਕਰਕੇ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਅਤੇ ਨੇਚਰ ਦੇ ਉੱਪਰ ਪੇਂਟਿੰਗ ਕਰਨਾ ਬਹੁਤ ਪਸੰਦ ਹੈ ਮੈਂ ਨੇਚਰ ਦੇ ਉੱਪਰ ਬਹੁਤ ਸਾਰੀਆਂ ਪੇਂਟਿੰਗ ਬਣਾਈਆਂ ਹਨ ਜਿਵੇਂ ਕਿ ਹਰਿਆਲੀ ਝਰਨੇ ਪਹਾੜ ਅਤੇ ਕਈ ਹੋਰ ਚੀਜ਼ਾਂ ਵੀ ਮੈਨੂੰ ਨੇਚਰ ਨਾਲ ਬਹੁਤ ਪਿਆਰ ਹੈ ਅਤੇ ਮੈਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਵੀ ਬਹੁਤ ਪਸੰਦ ਹੈ ਅਤੇ ਮੈਨੂੰ ਅਲੱਗ ਅਲੱਗ ਜਗ੍ਹਾ 'ਤੇ ਘੁੰਮਣਾ ਵੀ ਪਸੰਦ ਹੈ ਬਹੁਤ ਪਸੰਦ ਹੈ ਇਸ ਲਈ ਇਸ ਲਈ ਮੈਂ ਬਹੁਤ ਸਾਰੇ ਵਿਊ ਦੇਖ ਕੇ ਉਹਨਾਂ 'ਤੇ ਪੇਂਟਿੰਗ ਕਰਨਾ ਪਸੰਦ ਕਰਦੀ ਹਾਂ ਧੰਨਵਾਦ